ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਮੈਮ ਵੈਸੇ ਸਾਡੇ ਕੋਲ ਸਾਰੀਆਂ ਐਕਟੀਵਿਟੀਆਂ ਨੇ ਜਿਵੇਂ ਬੱਚੇ ਦੀ ਜਿਵੇਂ ਕਿ ਗਰੋਥ ਕਰਨ ਲਈ ਆਪਾਂ ਦੇਖੀਏ ਜਿਵੇਂ ਕਿ ਆਪਣੀ ਪੇਂਟਿੰਗ ਕਲਾਸਿਸ ਹੋ ਗਈਆਂ ਡਰੋਨ ਕਲਾਸਿੰਗ ਹੋ ਗਈਆਂ ਠੀਕ ਹ ਤੇ ਨਾਲ ਦੀ ਨਾਲ ਆਪਾਂ ਡਾਂਸ ਕਲਾਸ ਹੋ ਗਈਆਂ ਤੇ ਬੱਚੇ ਨੂੰ ਅਬੈਕਸ ਦਿਖਾਣਾ ਵਾ ਮੈਥ ਦਾ ਬੇਸਿਕ ਮੈਥ ਹੋ ਗਿਆ ਜਿਵੇਂ ਆਪਣਾ ਉਹਨੂੰ ਸਿਖਾਉਣ ਦੀ ਕਲਾਸਿਸ ਵੀ ਅਸੀਂ ਲੈਦੇ ਆ ਹਾਂਜੀ ਹਾਂਜੀ ਬਾਕੀ ਤੁਸੀਂ ਟਾਈਮ ਦੱਸ ਦੋ ਕਿੰਨਾ ਮਤਲਬ ਬੱਚੇ ਬਾਰੇ ਦੋ ਬੈਚ ਹੁੰਦੇ ਨੇ ਮਤਲਬ ਸਾਡੇ ਸਵੇਰੇ ਤੇ ਸ਼ਾਮ ਦੇ ਤੁਸੀਂ ਇਹ ਤੁਸੀਂ ਦੱਸੋ ਕਰਾਉਣਾ ਕੀ ਬੱਚੇ ਨੂੰ ਹਾਂਜੀ ਹਾਂਜੀ ਮੈਮ ਠੀਕ ਹੈ ਜੀ ਮੈਮ ਤੇ ਅੱਛਾ ਦੇਖੋ ਮੈਮ ਤੁਹਾਨੂੰ ਮੈਂ ਕਵਾਂ ਕਿ ਤੁਸੀਂ ਫਿਰ ਇਹਨੂੰ ਡਾਂਸਿੰਗ ਕਲਾਸ ਤੁਹਾਡੀ ਪਾਓ ਠੀਕ ਹੈ ਮਤਲਬ ਇਹਦੀ ਅੱਛੀ ਹੋਏਗੀ ਵਧੀਆ ਬੱਚੇ ਦੀ ਐਕਟੀਵਿਟੀ ਰਹਿੰਦੀ ਆਊਟ ਡੋਰ ਐਕਟੀਵਿਟੀ ਰਹਿੰਦੀ ਆ ਠੀਕ ਹੈ ਇਹਦੀ ਹਾਂਜੀ ਡਾਂਸ ਕਲਾਸ ਲਵਾਓ ਇਹਦੀ ਇੱਕ ਬਾਕੀ ਤੁਸੀਂ ਥੋੜਾ ਜਿਹਾ ਟਾਈਮ ਹੋਰ ਦੇਣਾ ਚਾਹੁੰਦੇ ਤੇ ਇੱਕ ਨੀ ਨਾਲ ਡਰਾਇੰਗ ਕਲਾਸਿਸ ਲਵਾ ਦੋ ਮਤਲਬ ਮੋਸਟ ਤੁਹਾਡੇ ਕੋਲ ਪੇਰੈਂਟਸ ਆਹ ਲਵਾਉਂਦੇ ਨੇ ਤੇ ਅਸੀਂ ਮਾ ਅਲਟਨੇਟਿਵ ਕਲਾਸ ਲੈਦੇ ਆ ਕਦੀ ਆਹ ਕਲਾਸ ਰੱਖ ਲਈ ਕਦੀ ਦੂਜੀ ਕਲਾਸ ਰੱਖ ਲਈ ਕਦੀ ਡਾਂਸ ਕਲਾਸਿਸ ਕਦੀ ਡਰੋਇੰਗ ਕਲਾਸ ਹੋ ਗਈ ਮਤਲਬ ਵਧੀਆ ਹੁੰਦਾ ਬੱਚੇ ਦੇ ਲਈ ਹਾਂਜੀ ਹਾਂਜੀ ਮੈਮ ਪੂਰੇ ਚਾਰ ਚਾਰ ਤ ਤਰਾਂ ਦੀ ਡਾਂਸ ਫਲੋਕ ਕਰਾਵਾਂਗੇ ਅਸੀਂ ਇੱਕ ਬੱਚੇ ਨੂੰ ਐਰੋਬਿਕਸ ਵੀ ਕਰਾਵਾਂਗੇ ਥੋੜਾ ਬਹੁਤ ਤੇ ਬੱਚੇ ਲਈ ਥੋੜਾ ਬਹੁਤ ਅਸੀਂ ਭੰਗੜਾ ਕਰਾਵਾਂਗੇ ਬਾਕੀ ਬੋਲੀਵੁੱਡ ਕਰਾਇਆ ਜਾਊਗਾ ਉਹਨੂੰ ਸਭ ਕੁਝ ਕਰਾਵਾਂਗੇ ਉਹ ਹਾਂਜੀ ਹਾਂਜੀ ਮੈਮ ਸਾਡਾ ਪੈਕਜ ਹੁੰਦਾ ਮਤਲਬ ਤੁਸੀਂ ਇਕ ਮਹੀਨੇ ਦਾ ਦੇਖ ਲਓ ਜੀ ਤੁਸੀਂ ਦੋ ਜਿਵੇਂ ਕੋਲ ਰੱਖੇ ਨੇ ਉਹੀ ਪੰਦਰਾਂ ਕ ਸੋ ਰੁਪਏ ਮਹੀਨਾ ਲੈਦੇ ਆ ਅਸੀਂ ਤੁਸੀਂ ਇੱਕ ਰੱਖੋਗੇ ਤਾਂ ਹਜ਼ਾਰ ਰੁਪਏ ਮਹੀਨਾ ਬਾਕੀ ਜਿਵੇਂ ਜਿਵੇਂ ਤੁਸੀਂ ਵਧਵਾਉਂਦੇ ਰਹੋਗੇ ਅਸੀਂ ਫਾਈਵ ਹੰਡਰਡ ਰੁਪੀਸ ਚਾਰਜ ਲੈਂਦੇ ਰਵਾਂਗੇ ਹਾਂਜੀ ਦੋ ਘੰਟੇ ਕਲਾਸਿਸ ਹੋਏਗੀ ਸਾਡੀ ਇੱਕ ਸਵੇਰੇ ਬੈਚ ਹੈ ਇੱਕ ਸ਼ਾਮੀ ਬੈਚ ਹੈ ਜਿੱਦਾਂ ਤੁਹਾਨੂੰ ਸਹੀ ਲੱਗੇ ਉਦਾਂ ਕਰ ਲੀਓ ਮਤਲਬ ਤੁਸ ਮਤਲਬ ਦੇਖ ਲਓ ਸੈਚਰਡ ਸੰਡੇ ਮੈਮ ਉਹ ਮਤਲਬ ਸ਼ਨੀਵਾਰ ਤੇ ਆਪਣਾ ਐਤਵਾਰ ਵਾਲਾ ਛੁੱਟੀ ਹੁੰਦੀ ਬੱਚਿਆਂ ਲਈ ਬਾਕੀ ਪੰਜ ਦਿਨ ਅਸੀਂ ਲਗਾਤਾਰ ਕਲਾਸਾਂ ਲੈਂਦੇ ਆ ਦੋ ਦੋ ਘੰਟੇ ਦੀ ਹਾਂਜੀ ਹਾਂਜੀ ਇਹ ਆਪਣੀਆਂ ਕਲਾਸਾਂ ਦਾ ਟਾਈਮ ਹੋ ਗਿਆ ਮੋਰਨਿੰਗ ਹੋ ਗਿਆ ਆਪਣਾ ਸਾਢੇ ਨੋ ਤੋਂ ਲੈ ਕੇ ਸਾਢੇ ਬਾਰਾਂ ਤੱਕ ਤੇ ਸ਼ਾਮੀ ਆਪਣਾ ਹੋ ਗਿਆ ਸਾਢੇ ਚਾਰ ਤੋਂ ਲੈ ਕੇ ਸਾਢੇ ਛੇ ਤੱਕ ਮੈਮ ਬਾਕੀ ਬੱਚੇ ਦਾ ਪਾਣੀ ਤੇ ਬੋਤਲ ਵਾਟਰ ਬੋਟਲ ਜਿਹੜੀ ਤੁਸੀਂ ਕਹਿੰਦੇ ਬੋਤਲ ਆਪਣੀ ਤੇ ਖਾਣ ਪੀਣ ਦਾ ਸਮਾਨ ਤੁਸੀਂ ਦੇ ਕੇ ਭੇਜੋਗੇ ਇੱਥੇ ਮਤਲਬ ਅਸੀਂ ਇਹ ਨਹੀਂ ਪ੍ਰੋਵਾਈਡ ਕਰਦੇ ਮੈਡਮ ਹਰ ਹਰ ਕਲਾਸ ਦਾ ਅਲੱਗ ਟੀਚਰ ਆ ਬਾਕੀ ਮੈਂ ਆਪ ਹਰ ਕਲਾਸ 'ਚ ਜਾ ਜਾ ਕੇ ਦੇਖਦਾ ਵਾਂ ਕਿ ਕੋਈ ਟੀਚਰ ਤੁਹਾਨੂੰ ਇੱਦਾਂ ਬਿਠਾ ਕੇ ਤਾਂ ਨੀ ਰੱਖਿਆ ਬੱਚੇ ਨੂੰ ਪੂਰੀ ਪੂਰੀ ਆਪਾਂ ਬੱਚੇ ਨੂੰ ਦੇਖਾਂਗੇ ਤਰੀਕੇ ਨਾਲ ਕਿੱਦਾਂ ਬੱਚਾ ਕਰ ਰਿਹਾ ਡਰੋਇੰਗ 'ਚ ਵੀ ਦੇਖੋ ਆਪਾਂ ਤਿੰਨ ਤਿੰਨ ਡਰਾਇੰਗ ਕਰਾਵਾਂਗੇ ਇਹਨੂੰ ਵਾਟਰ ਕਲਰ ਕਰਾਵਾਂਗੇ ਪੈਨਸਲ ਕਲਰ ਵੀ ਕਰਾਵਾਂਗੇ ਤੇ ਆਪਣੇ ਆਇਲ ਪੇਸਟਲ ਸਾਰੇ ਮਤਲਬ ਇਹਨਾਂ ਨੂੰ ਤਿੰਨ ਤਰ੍ਹਾਂ ਦੇ ਕਰਾਵਾਂਗੇ ਅਸੀਂ ਹਰ ਚੀਜ਼ ਦੀ ਦੋ ਦੋ ਸਕੈਚ ਬਣਵਾਵਾਂਗੇ ਹਾਂਜੀ ਹਾਂਜੀ ਮੈਂ ਤੁਹਾਡਾ ਬੱਚਾ ਮਤਲਬ ਆਲ ਰਾਊਡਰਰ ਦਾਂਗੇ ਮੈਮ ਜਿਵੇਂ ਦੇਖੋ ਮਤਲਬ ਮੋਸਟਲੀ ਕਲਰ ਤਾਂ ਤੁਹਾਡੇ ਹੋਊਗੇ ਕਲਰ ਤੁਸੀਂ ਲੈ ਕੇ ਆਓਗੇ ਜਿਵੇਂ ਬਾਕੀ ਇਹ ਹੋਗਾ ਪ੍ਰੈਕਟਿਸ ਬੱਚੇ ਨੂੰ ਅਸੀਂ ਆਪਣੇ ਪੈਸੇ ਤੋਂ ਕਰਾਵਾਂਗੇ ਜਦੋਂ ਟੈਸਟ ਹੋਊਗਾ ਬੱਚੇ ਦਾ ਹਾਂਜੀ

ਠੀਕ ਹੈ ਜੀ ਚਲੋ ਮੈਡਮ ਓਕੇ ਓਕੇ ਓਕੇ ਜੀ